ਮੈਂ ਅੱਜ ਤੁਹਾਨੂੰ ਬਰਤਨ ਧੋਣ ਦੀ ਪ੍ਰਕਿਰਿਆ ਬਾਰੇ ਦੱਸਣਾ ਚਾਹੁੰਗੀ ਬਰਤਨ ਧੋਣਾ ਇੱਕ ਅਹਿਮ ਘਰੇਲੂ ਕੰਮ ਹੈ ਜੋ ਹਰ ਰੋਜ਼ ਕੀਤਾ ਜਾਂਦਾ ਹੈ ਇਸ ਦੀ ਲੋੜ ਹਰ ਕਿਸੇ ਘਰ ਵਿੱਚ ਹੁੰਦੀ ਹੈ ਕਿਉਂਕਿ ਸਾਫ ਸਫਾਈ ਸਿਹਤ ਲਈ ਬਹੁਤ ਜ਼ਰੂਰੀ ਹੈ ਇਹ ਕੰਮ ਹੱਥ ਨਾਲ ਵੀ ਕੀਤਾ ਜਾ ਸਕਦਾ ਹੈ ਅਤੇ ਮਸ਼ੀਨ ਦੀ ਮਦਦ ਨਾਲ ਵੀ ਹੱਥ ਨਾਲ ਬਰਤਨ ਕਈ ਤਰ੍ਹਾਂ ਕਈ ਕਦ ਅ ਧੋਣ ਲਈ ਕਈ ਕਦਮ ਚੁੱਕੇ ਜਾਂਦੇ ਹਨ ਸਭ ਤੋਂ ਪਹਿਲਾਂ ਬਰਤਨਾਂ ਨੂੰ ਇਕੱਠਾ ਕਰਨਾ ਸਭ ਤੋਂ ਪਹਿਲਾਂ ਵਰਤੇ ਹੋਏ ਬਰਤਨ ਇਕੱਠੇ ਕੀਤੇ ਜਾਂਦੇ ਹਨ ਇਸ ਦੇ ਨਾਲ ਇਹ ਦੇਖਿਆ ਜਾਂਦਾ ਹੈ ਕਿ ਕਿਹੜੇ ਬਰਤਨ ਸਭ ਤੋਂ ਗੰਦੇ ਹਨ ਦੂਜਾ ਹੈ ਗੰਦੇ ਬਰਤਨਾਂ ਨੂੰ ਧੋਣਾ ਜਿਹੜੇ ਬਰਤਨ ਬਹੁਤ ਜ਼ਿਆਦਾ ਗੰਦੇ ਹਨ ਜਿਵੇਂ ਕਿ ਪਤੀਲੇ ਜਾਂ ਤਵੀਆਂ ਉਹਨਾਂ ਨੂੰ ਪਹਿਲਾਂ ਪਾਣੀ ਵਿੱਚ ਭਿੱਜਣ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਵਿੱਚ ਜੰਮਿਆ ਹੋਇਆ ਤੇਲ ਨਿਕਲ ਸਕੇ ਤੀਜਾ ਹੈ ਡਿਟਰਜਨ ਦੀ ਵਰਤੋਂ ਬਰਤਨਾਂ ਨੂੰ ਸਾਫ ਕਰਨ ਲਈ ਕੁਛ ਲੋਕ ਸਾਬਣ ਦਾ ਇਸਤੇਮਾਲ ਕਰਦੇ ਹਨ ਜਦ ਕਿ ਕੁਛ ਲੋਕ ਮਾਰਕੀਟ ਵਿੱਚ ਉਪਲਬਧ ਵੱਖ ਵੱਖ ਕਿਸਮ ਦੇ ਡਿਟਰਜੈਂਟ ਵਰਤਦੇ ਹਨ ਇਹ ਡਿਟਰਜੈਂਟ ਵੱਖ ਵੱਖ ਕਿਸਮ ਦੇ ਹੁੰਦੇ ਹਨ ਜਿਵੇਂ ਕਿ ਲਿਕੁਏਡ ਬਾਰ ਜਾਂ ਪਾਊਡਰ ਪਹਿਲਾਂ ਦੇ ਲੋਕ ਬਰੇਤੀ ਨਾਲ ਵੀ ਬਰਤਨਾਂ ਨੂੰ ਸਾਫ ਕਰਦੇ ਸੀ ਉਸ ਤੋਂ ਬਾਅਦ ਡਿਟਰਜੈਂਟ ਲਗਾਉਣ ਤੋਂ ਬਾਅਦ ਸਾਫ ਕਰਨ ਵਾਲੇ ਬ੍ਰਸ਼ ਜਾਂ ਝਾਂਵੇ ਦੀ ਮਦਦ ਨਾਲ ਬਰਤਨਾਂ ਨੂੰ ਰਗੜਿਆ ਜਾਂਦਾ ਹੈ ਇਹ ਰਗੜਨ ਬਰਤਨ ਦੇ ਸਮੱਗਰੀ ਦੇ ਅਨੁਸਾਰ ਨਰਮ ਜਾਂ ਸਖ਼ਤ ਹੋ ਸਕਦੀ ਹੈ ਜਿਵੇਂ ਕਿ ਤਵਾ ਪਤੀਲਾ ਨੂੰ ਆਹ ਆਪਾਂ ਜ਼ੋਰ ਦੀ ਰਗੜ ਸਕਦੇ ਹਾਂ ਤਾਂ ਕਿ ਉਹਨਾਂ ਵਿੱਚੋਂ ਘਿਓ ਚਾਹ ਪੱਤੀ ਆਦਿ ਨਿਕਲ ਸਕੇ ਰਗੜਨ ਤੋਂ ਬਾਅਦ ਬਰਤਨਾਂ ਨੂੰ ਸਾਫ ਪਾਣੀ ਨਾਲ ਧੋ ਕੇ ਸਾਬਣ ਦੀ ਝੱਗ ਤੋਂ ਮੁਕਤ ਕੀਤਾ ਜਾਂਦਾ ਹੈ ਇਹ ਕਦਮ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਸਾਬਨ ਦੀ ਝੱਲੀ ਬਰਤਨਾਂ 'ਤੇ ਰਹਿ ਜਾਣ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ ਬਰਤਨ ਧੋਣ ਤੋਂ ਬਾਅਦ ਇਹਨਾਂ ਨੂੰ ਸੁੱਕਣ ਲਈ ਰੈਕ ਦੇ ਵਿੱਚ ਰੱਖਿਆ ਜਾਂਦਾ ਹੈ ਜਾਂ ਕੱਪੜੇ ਨਾਲ ਪੂੰਝ ਕੇ ਵੀ ਇਸ ਨੂੰ ਸੁਕਾਇਆ ਜਾ ਸਕਦਾ ਹੈ ਇਸ ਤੋਂ ਅੱਜ ਮੈਂ ਸਾਨੂੰ ਦੱਸਣਾ ਚਾਹਾਂਗੀ ਕਿ ਤੇਲ ਵਾਲੇ ਬਰਤਨਾਂ ਦੀ ਸਫਾਈ ਕਿਵੇਂ ਕਰ ਸਕਦੇ ਹਾਂ ਸਭ ਤਤਕਾਲ ਧੋ ਸਕ ਆਪਾਂ ਤੇਲ ਵਾਲੇ ਬਰਤਨਾਂ ਨੂੰ ਤਤਕਾਲ ਧੋ ਸਕਦੇ ਹਾਂ ਕਿਉਂਕਿ ਲੱਗਿਆ ਹੋਇਆ ਤੇਲ ਜੰਮਦਾ ਨਹੀਂ ਅਤੇ ਅਸਾਨੀ ਨਾਲ ਉੱਤਰ ਜਾਂਦਾ ਹੈ ਗਰਮ ਪਾਣੀ ਦਾ ਇਸਤੇਮਾਲ ਵੀ ਆਪਾਂ ਤੇਲ ਵਾਲੇ ਬਰਤਨਾਂ ਲਈ ਕਰ ਸਕਦੇ ਹਾਂ ਇਸ ਦੇ ਨਾਲ ਬਰਤਨ ਜਲਦੀ ਸਾਫ ਹੋ ਜਾਂਦੇ ਹਨ ਬਰਤਨਾਂ ਨੂੰ ਕੁਛ ਸਮੇਂ ਲਈ ਗਰਮ ਪਾਣੀ ਵਿੱਚ ਭਿੱਜਣ ਦੇ ਨਾਲ ਵੀ ਉਹਨਾਂ ਤੋਂ ਤੇਲ ਆਸਾਨੀ ਨਾਲ ਉੱਤਰ ਜਾਂਦਾ ਹੈ ਮਜ਼ਬੂਤ ਡਿਟਰਜੈਂਟ ਜਿਵੇਂ ਕਿ ਲਿਕੂਅਡ ਡਿਟਰਜੈਂਟ ਜੋ ਖਾਸ ਕਰਕੇ ਤੇਲ ਨੂੰ ਸਾਫ ਕਰਨ ਲਈ ਬਣੇ ਹੋਣ ਬਰਤਨ ਧੋਣ ਵਿੱਚ ਬਹੁਤ ਮਦਦਗਾਰ ਸਾਬਿਤ ਹੁੰਦੇ ਹਨ ਬਾਕੀ ਗਰਮ ਪਾਣੀ ਵਿੱਚ ਬਰਤਨ ਤੇਲ ਵਾਲੇ ਭਿਓਂ ਕੇ ਰੱਖਣ ਲਈ ਰੱਖ ਰੱਖ ਸਕਦੇ ਹਾਂ ਜਿਸ ਦੇ ਨਾਲ ਉਹਨਾਂ ਵਿੱਚ ਲੱਗਿਆ ਹੋਇਆ ਤੇਲ ਥਿੰਧਾਈ ਬਹੁਤ ਜਲਦੀ ਨਿਕਲ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਸਾਬਣ ਨਾਲ ਰਗੜ ਰਗੜ ਕੇ ਸਾਫ ਕਰ ਦਿੱਤਾ ਜਾ ਸਕੇ ਫੇਰ ਉਹਨਾਂ ਨੂੰ ਸੁੱਕਨ ਰੱਖ ਦਿੱਤਾ ਜਾਵੇ ਤਾਂ ਕਿ ਉਹ ਚੰਗੀ ਤਰ੍ਹਾਂ ਸੁੱਕ ਜਾਣ ਅੰਤ ਵਿੱਚ ਹਰ ਇਹ ਕਹਿਣਾ ਚਾਹਵਾਂ ਹਰ ਘਰ ਵਿੱਚ ਬਰਤਨ ਧੋਣ ਦੀ ਪ੍ਰਕਿਰਿਆ ਕੁਛ ਅੰਸ਼ਾਂ ਵਿੱਚ ਵੱਖ ਵੱਖ ਹੋ ਸਕਦੀ ਹੈ ਪ੍ਰਮੁੱਖ ਤੌਰ 'ਤੇ ਇਹ ਹੀ ਕਦਮ ਮੌਜੂਦ ਹਨ ਇਸ ਪ੍ਰਕਿਰਿਆ ਨੂੰ ਵੱਖ ਵੱਖ ਤਰੀਕਿਆਂ ਨਾਲ ਨਿਭਾਇਆ ਜਾ ਸਕਦਾ ਹੈ ਪਰ ਉਦੇਸ਼ ਸਦਾ ਹੀ ਇੱਕੋ ਰਹਿੰਦਾ ਹੈ ਸਾਫ ਸੁਰੱਖਿਅਤ ਬਰਤਨ ਪ੍ਰਾਪਤ ਕਰਨਾ